ਮੇਰਾ ਨਾਮ ਰਜੇਸ਼ ਕੁਮਾਰ ਹੈ ਮੈਂ ਫਿਰੋਜ਼ਪੁਰ ਕਲਾਂ ਦਾ ਰਹਿਣ ਵਾਲਾ ਹਾਂ ਮੈਂ ਇੱਕ ਵਾਰ ਆਪਣੇ ਪਿਤਾ ਜੀ ਤੋਂ ਇਹ ਕਹਾਣੀ ਸੁਣੀ ਕਿ ਇੱਕ ਰਾਜਾ ਸੀ ਜਿਸ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਸੀ ਮੈਂ ਜਲਦੀ ਜਲਦੀ ਪਿਤਾ ਜੀ ਨੂੰ ਦੱਸਿਆ ਕਿ ਉਸ ਰਾਜੇ ਦੀ ਤਾਂ ਇੱਕੋ ਅੱਖ ਸੀ ਇੱਕੋ ਅੱਖ ਸੀ ਉਹ ਇੱਕ ਅੱਖ ਨਾਲ ਹੀ ਦੇਖਦਾ ਸੀ ਪਿਤਾ ਜੀ ਨੇ ਮੈਨੂੰ ਉਸ ਮਹਾਨ ਰਾਜੇ ਬਾਰੇ ਦੱਸਿਆ ਕਿ ਪੁੱਤਰ ਉਸ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਕਿ ਇੱਕੋ ਅੱਖ ਸੁਲੱਖਣੀ ਜਿਹੜੀ ਲੱਖਾਂ ਨੂੰ ਤਾਰੇ ਝੁੱਕ ਝੁੱਕ ਕਰਨ ਸਲਾਮਾਂ ਦੋ ਅੱਖਾਂ ਵਾਲੇ ਮੈਂ ਜਦੋਂ ਪਿਤਾ ਜੀ ਨੂੰ ਇਸ ਗੱਲ ਦਾ ਇਸ ਕਹਾਵਤ ਦਾ ਮਤਲਬ ਪੁੱਛਿਆ ਤਾਂ ਉਹਨਾਂ ਜੀ ਨੇ ਮੈਨੂੰ ਦੱਸਿਆ ਕਿ ਉਸ ਰਾਜੇ ਦੀ ਇੱਕ ਅੱਖ ਹੀ ਇੰਨੀ ਸੁਲੱਖਣੀ ਸੀ ਕਿ ਉਸ ਨੂੰ ਦੋ ਅੱਖਾਂ ਵਾਲੇ ਦੋ ਨੈਣਾਂ ਵਾਲੇ ਝੁੱਕ ਝੁੱਕ ਕੇ ਸਲਾਮਾਂ ਕਰਦੇ ਸਨ ਉਹ ਬੜਾ ਹੀ ਵਧੀਆ ਰਾਜਾ ਸੀ ਧੰਨਵਾਦ